ਦੁਧਾਰੂ ਪਸ਼ੂਆਂ ਲਈ ਅਚਾਰ ਦੀ ਕੀ ਮਹੱਤਤਾ ਹੈ ਇਹ ਕਿਵੇਂ ਤਿਆਰ ਕੀਤਾ ਜਾਂਦਾ ਹੈ ਸਾਰੀ ਪ੍ਰਕਿਰਿਆ ਦਾ ਵਰਣਨ ਕਰੋ ਅਚਾਰ ਬਾਰੇ ਤਾਂ ਕੁਛ ਪਤਾ ਨਹੀਂ ਹੈ ਪਰ ਇਹਨਾਂ ਦਾ ਮਤਲਬ ਜਿੱਦਾਂ ਹੁਣ ਖੱਲ ਵਗੈਰਾ ਜੋ ਵੀ ਇਹਨਾਂ ਨੂੰ ਦਿੰਨੇ ਆ ਆਪਾਂ ਖਲ ਖੁਲ ਵੀ ਪਾਣੀ 'ਚ ਭਿਉਂ ਕੇ ਰੱਖਣੀ ਪੈਂਦੀ ਆ ਜਿੱਦਾਂ ਹੁਣ ਆਪਾਂ ਦੁਪਹਿਰ ਵੇਲੇ ਇਹਨਾਂ ਨੂੰ ਸੰਨੀ 'ਚ ਮਤਲਬ ਖੱਲ ਪਾਣੀ 'ਚ ਭਿਉਂ ਕੇ ਜਿਹੜੀ ਆਪਾਂ ਰੱਖਦੇ ਹਾਂ ਉਹ ਰਲਾਉਣੀ ਪੈਂਦੀ ਆ ਅਤੇ ਕਾਲਾ ਨਮਕ ਵਗੈਰਾ ਇਹਨਾਂ ਨੂੰ ਦਿੱਤਾ ਜਾਂਦਾ ਉਹਦੇ ਨਾਲ ਨਮਕ ਨਾਲ ਵੀ ਕਾਫ਼ੀ ਮਤਲਬ ਬੈਨੀਫਿਟ ਹੁੰਦਾ ਹੈ ਅਤੇ ਇਹ ਵਧੀਆ ਰਹਿੰਦਾ